ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਅਗਰ ਤੁਸੀਂ ਜੇ ਘੁੰਮਣਾ ਚਾਹੁੰਦੇ ਹੋ ਤਾਂ ਤੁਸੀਂ ਇੰਝ ਕਰਿਉ ਮੈਂ ਤੁਹਾਨੂੰ ਟਾਈਮ ਦੱਸ ਦਿੰਦੀ ਹਾਂ ਕਿ ਜੇ ਤੁਸੀਂ ਅੰਮ੍ਰਿਤਸਰ ਵੀ ਘੁੰਮਣਾ ਚਾਹੁੰਦੇ ਹੋ ਉੱਥੇ ਦੇ ਬਹੁਤ ਸਾਰੇ ਏਰੀਆਜ਼ ਹੁੰਦੇ ਆ ਹੈ ਨਾ ਫਿਰੋਜ਼ਪੁਰ ਜਾਣਾ ਚਾਹੁੰਦੇ ਜਿਵੇਂ ਤੁਸੀਂ ਦੱਸਿਆ ਪੱਟੀ ਜਾਣਾ ਚਾਹੁੰਦੇ ਹੋ ਗੁਰਦਾਸਪੁਰ ਤਰਨ ਤਾਰਨ ਅੰਮ੍ਰਿਤਸਰ ਹੈ ਨਾ ਇਹਦੇ ਵਿੱਚ ਕਿ ਟ੍ਰੇਨ ਟ੍ਰੇਨਾਂ ਜਿਹੜੀਆਂ ਜਾਂਦੀਆਂ ਨਾ ਉਹਨਾਂ ਦਾ ਆਪਣਾ ਇੱਕ ਟਾਈਮ ਆ ਅਗਰ ਤੁਸੀਂ ਤ ਤਰਨ ਤਾਰਨ ਜਾਣਾ ਚਾਹੁੰਦੇ ਹੋ ਅਤੇ ਉਹਦੀ ਟ੍ਰੇਨ ਜਿਹੜੀ ਆ ਨਾ ਇੱਥੋਂ ਰੇਲਵੇ ਸਟੇਸ਼ਨ ਤੋਂ ਇੱਕ ਵਜੇ ਚੱ ਰਵਾਨਾ ਹੁੰਦੀ ਆ ਠੀਕ ਆ ਅਤੇ ਤਿੰਨ ਸਾਢੇ ਤਿੰਨ ਵਜੇ ਉਹ ਤੱਕ ਪਹੁੰਚ ਜਾਂਦੀ ਆ ਠੀਕ ਆ ਅਤੇ ਜਿੱਥੇ ਜਿੱਥੇ ਵੀ ਜਾਣਾ ਨਾ ਉਹਦੇ ਫੇਰ ਹਿਸਾਬ ਦੇ ਨਾਲ ਜਿਹੜੀ ਉਹ ਟ੍ਰੇਨ ਜਿਹੜੀ ਉਹਦੀ ਵੱਖਰੇ ਵੱਖਰੇ ਟਾਈਮ ਹੈਗੀ ਆ ਠੀਕ ਆ ਅਤੇ ਅਗਰ ਅਗਰ ਤੁਸੀਂ ਸਾਰਾ ਘੁੰਮਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਜਿਹੜੀ ਟਿਕਟ ਬੁੱਕ ਕਰਵਾ ਲਉ ਅਤੇ ਉਹਦੇ ਅਕੋਰਡਿੰਗ ਤੁਹਾਡਾ ਬਹੁਤ ਵਧੀਆ ਜਿਹੜਾ ਸਫਰ ਰਹੇਗਾ ਠੀਕ ਹੈ ਅਤੇ ਉਹਦੇ ਨਾਲ ਨਾਲ ਤੁਹਾਨੂੰ ਮੈਂ ਪੂਰਾ ਇੱਕ ਸਕਰੀਨਸ਼ੋਟ ਜਿਹੜਾ ਵਾ ਫੋਨ ਦੇ ਵਿੱਚ ਸੈਂਡ ਕਰ ਦਿੰਦੀ ਹਾਂ ਉਹਦੇ ਵਿੱਚ ਪੂਰਾ ਸ਼ਡਿਊਲ ਲਿਖਿਆ ਹੋਇਆ ਵਾ ਕਿੰਨੇ ਵਜੇ ਤੋਂ ਟਰੇਨ ਜਿਹੜੀ ਚੱਲੇਗੀ ਅਤੇ ਕਿੰਨੇ ਵਜੇ ਉੱਥੇ ਪਹੁੰਚੇਗੀ ਠੀਕ ਹੈ ਪ੍ਰੋਪਰ ਟਾਈਮ ਦੇ ਨਾਲ ਜਿਹੜਾ ਵਾ ਸਮੇਂ ਦੇ ਸਿਰ ਤੁਹਾਨੂੰ ਉੱਥੇ ਪਹੁੰਚਣਾ ਪੈਣਾ ਰੇਲਵੇ ਸਟੇਸ਼ਨ ਪਹਿਲਾਂ ਤੁਸੀਂ ਇਹ ਵੀ ਚੀਜ਼ ਆਪਣੇ ਧਿਆਨ 'ਚ ਰੱਖਿਓ ਠੀਕ ਹੈ ਅਤੇ ਤੁਸੀਂ ਕੋਸ਼ਿਸ਼ ਕਰਿਓ ਕਿ ਅੱਧਾ ਘੰਟਾ ਜਾਂ ਪੰਦਰਾਂ ਮਿੰਟ ਪਹਿਲਾਂ ਟਾਈਮ ਤੋਂ ਤੁਸੀਂ ਇਹ ਰੇਲਵੇ ਸਟੇਸ਼ਨ ਪਹੁੰਚੋ ਤਾਂ ਕਿ ਜਿਹੜੀ ਤੁਹਾਡੀ ਟਰੇਨ ਆ ਉਹ ਮਿਸ ਨਾ ਹੋ ਜੇ ਠੀਕ ਹੈ ਹਾਂਜੀ ਹਾਂਜੀ ਜਿਹੜੀ ਟ੍ਰੇਨ ਜਿੱਦਾਂ ਤੁਸੀਂ ਜਾਓਗੇ ਨਾ ਕਿਤੇ ਘੁੰਮਣ ਵਾਸਤੇ ਉਹ ਦੀਆਂ ਅਤੇ ਜਾਣ ਦੀਆਂ ਲੱਗਣਗੀਆਂ ਉਸੇ ਹਿਸਾਬ ਦੇ ਨਾਲ ਜਿਹੜਾ ਉੱਥੋਂ ਵਾਪਸ ਆਉਂਦਿਆ ਵੀ ਟ੍ਰੇਨ ਦਾ ਜਿਹੜਾ ਹੈਗੀ ਆ ਫਸਿਲੀਟੀ ਉਹ 'ਤੇ ਤੁਹਾਨੂੰ ਮਿਲੇਗੀ ਠੀਕ ਹੈ ਨਾ ਉਹਦੀ ਤੁਹਾਨੂੰ ਕੋਈ ਤੰਗੀ ਨਹੀਂ ਆਏਗੀ ਅਤੇ ਜਿਤਨਾ ਤੁਸੀਂ ਜਾਉਗੇ ਜਿਹੜੇ ਜਿਹੜੇ ਵੀ ਤੁਸੀਂ ਦੇਸ਼ ਘੁੰਮਣੇ ਆ ਨਾ ਜਗ੍ਹਾ ਘੁੰਮਣੀ ਆ ਹੈ ਨਾ ਉਹਦੇ ਵਿੱਚ ਇਹ ਆਉਣ ਦਾ ਤਾਂ ਟ੍ਰੇਨਾਂ ਦਾ ਟਾਈਮ ਉਹ ਵੀ ਇੱਕ ਸੈਟ ਕੀਤਾ ਗਿਆ ਵਾ ਠੀਕ ਆ ਉਹ ਵੀ ਤੁਹਾਨੂੰ ਅਸੀਂ ਦੱਸ ਦੇਵਾਂਗੇ ਠੀਕ ਆ ਹਾਂਜੀ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਹਾਂਜੀ ਠੀਕ ਆ ਜੀ ਓਕੇ ਹਾਂਜੀ